ਤੀਹ ਨਵੰਬਰ ਦੋ ਹਜ਼ਾਰ ਪੰਜ ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ ਪੰਜ ਜਨਵਰੀ ਉੱਨੀ ਸੌ ਤੀਹ ਤੇਰ੍ਹਾਂ ਸਤੰਬਰ ਉੱਨੀ ਸੌ ਸਤਾਰ੍ਹਾਂ ਨੂੰ ਵੀਹ ਜੂਨ ਉੱਨੀ ਸੌ ਵੀਹ